ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਲਾਗੇ ਜੋ ਪਿੰਡ ਦੇ ਹਸਪਤਾਲ ਆ ਉੱਥੇ ਸਿਹਤ ਸੇਵਾਵਾਂ ਇੰਨੀਆਂ ਵਧੀਆ ਨਹੀਂ ਹਨ ਜਿਵੇਂ ਕਿ ਸ਼ਹਿਰ ਦੇ ਵਿੱਚ ਬਹੁਤ ਵਧੀਆ ਹਾਈਜੈਨਿਕ ਵਾਰਡ ਹੁੰਦੇ ਆ ਇੱਦਾਂ ਦੇ ਸਾਡੇ ਹੋਸਪਿਟਲ ਦੇ ਵਿੱਚ ਵਾਰਡ ਨਹੀਂ ਹੈਗੇ ਦਵਾਈਆਂ ਦੀ ਵੀ ਬਹੁਤ ਜ਼ਿਆਦਾ ਘਾਟ ਰਹਿੰਦੀ ਹੈ ਕਦੀ ਹੁੰਦੀਆਂ ਕਦੀ ਨਹੀਂ ਹੁੰਦੀਆਂ ਹਰੇਕ ਚੀਜ਼ ਸਮੇਂ ਸਿਰ ਉਪਲਬਧ ਨਹੀਂ ਹੁੰਦੀ ਉੱਥੇ ਇਸ ਲਈ ਸਾਨੂੰ ਸ਼ਹਿਰ ਵੱਲ ਜਾਣਾ ਪੈਂਦਾ ਵਾ ਕਸਬੇ ਦੇ ਵਿੱਚ ਜੋ ਇੰਨੀਆਂ ਬਿਹਤਰ ਸੇਵਾਵਾਂ ਜਿਹੜਿਆਂ ਵਾ ਉਪਲਬਧ ਨਹੀਂ ਹਨ ਜਿਵੇਂ ਕਿ ਚੰਗੀ ਕੁਆਲਿਟੀ ਦੀ ਮੈਡੀਸਨ ਹੋ ਗਈ ਚੰਗੇ ਡਾਕਟਰ ਸਪੈਸ਼ਲਿਸਟ ਸਾਰੇ ਜਿਹੜੇ ਆ ਉਹ ਅਵੇਲੇਬਲ ਨਹੀਂ ਹੈ ਹਸਪਤਾਲ ਦੇ ਵਿੱਚ ਲੋੜੀਂਦੀਆਂ ਦਵਾਈਆਂ ਨਹੀਂ ਮਿਲਦੀਆਂ ਇਹ ਪੂਰਾ ਸਾਜੋ ਸਮਾਨ ਇੱਥੇ ਹੋਸਪਿਟਲ ਦੇ ਵਿੱਚ ਹੋਵੇ ਤਾਂ ਸ਼ਹਿਰ ਵੱਲ ਜਾਣ ਦੀ ਲੋੜ ਨਾ ਪਵੇ ਇਸ ਲਈ ਜਿਹੜਾ ਵਾ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਵਾ ਅਤੇ ਸਾਰੀਆਂ ਜਿਹੜੀਆਂ ਵਾ ਸੇਵਾਵਾਂ ਇੱਥੇ ਮੈਡੀਸਨ ਓਕਸੀਜਨ ਵਗੈਰਾ ਜੋ ਆ ਪੂਰੀਆਂ ਕਰਨੀਆਂ ਚਾਹੀਦੀਆਂ